ਹਾਂਜੀ ਅੱਜ ਆਪਾਂ ਗੱਲਬਾਤ ਕਰਦੇ ਹਾਂ ਮਾਰਸਲ ਆਰਟਸ ਸਿਖਾਉਣ ਜਾਂ ਕੋਰਸ ਕਰਨ ਦੇ ਵੇਲੇ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਵੀ ਅਸੀਂ ਬੱਚਿਆਂ ਨੂੰ ਜਾਂ ਕੋਈ ਟੀਮ ਆ ਗਈ ਜਿਹਨੂੰ ਅਸੀਂ ਮਾਰਸਲ ਆਰਟਸ ਦੀ ਸਿਖਲਾਈ ਦੇਣੀ ਆ ਉਹਨਾਂ ਨੂੰ ਮਾਰਸਲ ਆਰਟਸ ਦੇ ਕਰਨ ਦੇ ਤਰੀਕੇ ਕਿਹੜੇ ਕਿਹੜੇ ਆ ਨਾ ਕਰਨ ਵਾਲੀਆਂ ਗੱਲਾਂ ਕਿਹੜੀਆਂ ਨੇ ਕਰਨ ਦੇ ਤਰੀਕੇ ਤਾਂ ਸਾਨੂੰ ਅਗਰ ਵਧੀਆ ਕਰਾਂਗੇ ਤਾਂ ਉਹਦੇ ਸਾਨੂੰ ਬੈਨੀਫਿਟ ਜਾਂ ਫ਼ਾਇਦੇ ਕੀ ਨੇ ਅਗਰ ਅਸੀਂ ਮਾਰਸਲ ਆਰਟਸ ਨੂੰ ਵਧੀਆ ਨਹੀਂ ਕਰਾਂਗੇ ਤਾਂ ਉਹਦੇ ਨੁਕਸਾਨ ਕੀ ਨੇ ਸਭ ਤੋਂ ਪਹਿਲਾਂ ਤਾਂ ਇਹ ਫ਼ਾਇਦੇ ਅਤੇ ਨੁਕਸਾਨ ਬਾਰੇ ਉਹਨਾਂ ਨੂੰ ਦੱਸਾਂਗੇ ਉਸ ਤੋਂ ਬਾਅਦ ਮੰਨ ਲਓ ਅਸੀਂ ਕਰਾਟੇ ਦੀ ਸਿਖਲਾਈ ਦੇਣੀ ਆ ਸਭ ਤੋਂ ਪਹਿਲਾਂ ਜਿਹੜੇ ਵੀ ਕਰਾਟੇ ਟੀਮ ਵਾਲੇ ਕੁੜੀਆਂ ਜਾਂ ਮੁੰਡੇ ਨੇ ਉਹਨਾਂ ਤੋਂ ਅਸੀਂ ਸਹਿਮਤੀ ਲੈਣੀ ਆ ਵੀ ਹਾਂ ਮੈਂ ਫਿੱਟ ਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਇਹ ਕਰ ਸਕਦਾ ਅਗਰ ਕੋਈ ਮੈਡੀਕਲ ਪ੍ਰੋਬਲਮ ਨਾਲ ਬੱਚਾ ਹੈ ਤਾਂ ਉਹਨੂੰ ਐਸੀ ਟੀਮ ਦੇ ਵਿੱਚ ਚੋਣ ਨਾ ਕੀਤੀ ਜਾਵੇ ਪਹਿਲਾਂ ਕੀ ਆ ਫਿਜੀਕਲ ਫਿੱਟ ਹੋਣੇ ਚਾਹੀਦੇ ਆ ਤੰਦਰੁਸਤ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਹੀ ਇਹਨਾਂ ਨੂੰ ਕੋਚਿੰਗ ਦੇਣੀ ਚਾਹੀਦੀ ਹੈ ਕੋਚਿੰਗ ਦੇਣ ਲਈ ਸਭ ਤੋਂ ਪਹਿਲਾਂ ਸਰੀਰ ਨੂੰ ਬਾਰਮ ਅਪ ਕਰਨਾ ਅਗਰ ਸਾਡਾ ਸਰੀਰ ਵਾਰਮ ਅਪ ਆ ਅਸੀਂ ਸਰੀਰ ਦੀ ਹਿਲ ਜੁਲ ਕਰਾਂਗੇ ਤਾਂ ਸਾਡਾ ਸਰੀਰ ਬਿਲਕੁਲ ਸਹੀ ਰਹੇਗਾ ਅਗਰ ਸਾਡਾ ਸਰੀਰ ਹੀ ਠੰਡਾ ਹੈ ਬਾਰਮ ਅਪ ਨਹੀਂ ਹੈ ਜਦੋਂ ਅਸੀਂ ਕੋਈ ਵੀ ਐਕਸਰਸਾਈਜ਼ ਉਹਨਾਂ ਨੂੰ ਕਰਾਵਾਂਗੇ ਤਾਂ ਸਰੀਰ ਦੇ ਵਿੱਚ ਕੀ ਆ ਪ੍ਰੋਬਲਮ ਆਵੇਗੀ ਤਾਂ ਇਹ ਬੈਟਰ ਹੈ ਸਭ ਤੋਂ ਪਹਿਲਾਂ ਕੀ ਆ ਕੋਈ ਵੀ ਟੀਮ ਆ ਕਰਾਟੇ ਵਾਲੇ ਆ ਆਰਟਸ ਵਾਲੇ ਆ ਕੋਈ ਯੋਗਾ ਕਰਵਾਉਣਾ ਸਭ ਤੋਂ ਪਹਿਲਾਂ ਕੀ ਆ ਸਰੀਰ ਨੂੰ ਬਾਰਮ ਅਪ ਕਰਨਾ ਉਸ ਤੋਂ ਬਾਅਦ ਕੀ ਆ ਜਿਹੜਾ ਤੁਹਾਡਾ ਡਰੈਸ ਆ ਉਹ ਰਿਲੈਕਸ ਹੋਣਾ ਚਾਹੀਦਾ ਜਦੋਂ ਤੁਸੀਂ ਐਕਸਰਸਾਈਜ ਕਰਨੀ ਆ ਕੋਈ ਜਿਵੇਂ ਲੋਅਰ ਹੋ ਗਿਆ ਟੀਸ਼ਰਟ ਹੋ ਗਈ ਜਿਹਦੇ ਨਾਲ ਤੁਸੀਂ ਆਰਾਮ ਮਹਿਸੂਸ ਕਰੋ ਇੱਦਾਂ ਦਾ ਤੁਹਾਨੂੰ ਡਰੈਸ ਪਹਿਨਣਾ ਚਾਹੀਦਾ ਸਵੇਰ ਦੇ ਸਮੇਂ ਕੀ ਆ ਤੁਹਾਨੂੰ ਭੋਜਨ ਕਰਕੇ ਨਹੀਂ ਕੋਚਿੰਗ ਲੈਣੀ ਚਾਹੀਦੀ ਹਲਕਾ ਭੋਜਨ ਕਰਨਾ ਚਾਹੀਦਾ ਕੋਚਿੰਗ ਲੈਣ ਤੋਂ ਬਾਅਦ ਹੀ ਤੁਸੀਂ ਕੁਛ ਪੇਟ ਭਰ ਕੇ ਖਾ ਸਕਦੇ ਹੋ ਅਗਰ ਤੁਸੀਂ ਰੱਜ ਕੇ ਸਵੇਰੇ ਆ ਜਾਓਗੇ ਤਾਂ ਤੁਹਾਡਾ ਕੋਚਿੰਗ ਲੈਣ ਨੂੰ ਦਿਲ ਹੀ ਨਹੀਂ ਕਰੇਗਾ ਰਾਤ ਨੂੰ ਸੌਣ ਵੇਲੇ ਕੀ ਆ ਹਲਕਾ ਭੋਜਨ ਲੈਣਾ ਜਿਹੜਾ ਤੁਹਾਡਾ ਸਰੀਰ ਆ ਸਵੇਰੇ ਜਲਦੀ ਉੱਠ ਕੇ ਕੋਚਿੰਗ ਲੈਣ ਲਈ ਤਿਆਰ ਹੋਵੇ ਅਗਰ ਤੁਸੀਂ ਹੈਵੀ ਭੋਜਨ ਕਰੋਗੇ ਤਾਂ ਸਵੇਰੇ ਬੰਦਾ ਫਰੈੱਸ ਹੀ ਨਹੀਂ ਹੁੰਦਾ ਉਹਦਾ ਮਨ ਹੀ ਨਹੀਂ ਕਰੇਗਾ ਵੀ ਮੈਂ ਕੋਚਿੰਗ ਕਿਹੜੇ ਤਰੀਕੇ ਨਾਲ ਲਵਾਂ ਇਹ ਸਾਰੀਆਂ ਗੱਲਾਂ ਦਾ ਜੀ ਅਸੀਂ ਇਹਦੇ ਵਿੱਚ ਧਿਆਨ ਰੱਖਾਂਗੇ ਜਦੋਂ ਵੀ ਕਿਸੇ ਨੂੰ ਕੁਛ ਸਿਖਾਉਣਾ ਜਾਂ ਕੋਚਿੰਗ ਕਰਨਾ ਸਭ ਤੋਂ ਪਹਿਲਾਂ ਉਹਦੀ ਸਹਿਮਤੀ ਲੈਣੀ ਆ ਉਹਦੇ ਫ਼ਾਇਦੇ ਅਤੇ ਨੁਕਸਾਨ ਦੱਸਣੇ ਆ ਉਸਤੋਂ ਬਾਅਦ ਵਿੱਚ ਯੂਨੀਫਾਰਮ ਡਰੈਸ ਆ ਜਿਹੜੀ ਉਹਨਾਂ ਦੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਭੋਜਨ ਕਿੱਦਾਂ ਦਾ ਹੋਣਾ ਚਾਹੀਦਾ ਧੰਨਵਾਦ ਜੀ